ਐਮਾਜੋਨ ਗਾਹਕ ਸੇਵਾ ਕੇਂਦਰ ਜੀ ਹਾਂਜੀ ਜਿਹੜਾ ਤੁਹਾਡਾ ਪਹਿਲਾ ਪ੍ਰੋ ਸਮਾਨ ਭੇਜਿਆ ਸੀਗਾ ਉਹ ਵਧੀਆ ਸੀਗਾ ਠੀਕ ਢੰਗ ਨਾਲ ਪੋ ਕੋਲ ਪਹੁੰਚ ਗਿਆ ਸੀ ਪਰ ਜਿਹੜਾ ਦੂਜਾ ਮੈਂ ਔਡਰ ਕਰਿਆ ਉਹ ਸਮਾਨ ਵਿੱਚੋਂ ਟੁੱਟਿਆ ਹੋਇਆ ਸੀ ਉਹ ਠਈ ਠੀਕ ਢੰਗ ਨਾਲ ਨਾ ਪੈਕਿੰਗ ਸੀ ਉਹਦੀ ਤੇ ਉਹਦੀ ਮੇਰੀ ਸ਼ਿਕਾਇਤ ਤੁਸੀਂ ਦਰਜ਼ ਕਰੋ ਉਹ ਠੀਕ ਨਹੀਂ ਸੀਗਾ ਹਾਂਜੀ